ਸਤਿ ਸ਼੍ਰੀ ਅਕਾਲ ਜੀ ਅਜੋਕੇ ਯੁੱਗ ਨੇ ਟੈਕਨੋਲਜੀ ਨੇ ਬਿਰਧਾਂ ਅਤੇ ਦ੍ਰਿਸ਼ਟੀਹੀਣਾਂ ਬਹੁਤ ਹੀ ਮਦਦ ਕੀਤੀ ਹੈ ਟੈਕਨੋਲਜੀ ਦੇ ਜ਼ਰੀਏ ਜਿਹੜੇ ਬਜ਼ੁਰਗ ਜਾਂ ਬਿਰਧ ਮਾਂ ਪਿਉ ਸੀ ਉਹ ਆਪਣੇ ਬੱਚਿਆਂ ਨਾਲ ਬਾਹਰ ਗੱਲਬਾਤ ਕਰ ਸਕਦੇ ਹਨ ਅੱਗੇ ਪਿਛਲੇ ਸਮੇਂ ਵਿੱਚ ਜਦੋਂ ਬਿਰਧਾਂ ਨੂੰ ਕੋਈ ਵੀ ਕੰਮ ਕਾਰ ਕਰਨਾ ਹੁੰਦਾ ਸੀ ਉਹ ਆਪਣੇ ਸੁਨੇਹਾ ਭੇਜਣਾ ਹੁੰਦਾ ਸੀ ਉਹਨਾਂ ਨੂੰ ਚਿੱਠੀ ਲਿਖਣੀ ਪੈਂਦੀ ਸੀ ਜਾਂ ਕੁਝ ਅੱਜ ਕੱਲ੍ਹ ਟੈਕਨੋਲਜੀ ਦਾ ਜ਼ਮਾਨਾ ਹੈ ਜਿਸ ਦੇ ਰਾਹੀਂ ਜਿਹੜੇ ਬਜ਼ੁਰਗ ਬਿਰਧ ਮਾਂ ਬਾਪ ਹਨ ਉਹ ਆਪਣੇ ਬੱਚਿਆਂ ਨੂੰ ਉਹਨੂੰ ਫੋਨ ਕਰਕੇ ਉਹਨਾਂ ਦਾ ਹਾਲ ਚਾਲ ਪੁੱਛ ਕੇ ਦੱਸਦੇ ਹਨ ਪਤਾ ਕਰ ਸਕਦੇ ਹਨ ਇਸ ਤੋਂ ਇਲਾਵਾ ਟੈਕਨੋਲੋਜੀ ਨੇ ਬਿਰਧਾਂ ਨੂੰ ਹੋਰ ਵੀ ਸਹੂਲਤਾਂ ਦਿੱਤੀਆਂ ਹਨ ਜਿਵੇਂ ਕੋਈ ਵੀ ਨਿਊਜ਼ ਇਨਫੋਰਮੇਸ਼ਨ ਪ੍ਰਾਪਤ ਕਰਨੀ ਹੋਣ ਤਾਂ ਬਿਰਧਾਂ ਨੂੰ ਇਸ ਮੋਬਾਈਲ ਦੇ ਜ਼ਰੀਏ ਉਹ ਲੱਭ ਸਕਦੇ ਹਨ ਖਬਰਾਂ ਸੁਣ ਸਕਦੇ ਹਨ ਇਸ ਤੋਂ ਇਲਾਵਾ ਕੋਈ ਵੀ ਚੀਜ਼ ਨਵੀਂ ਸਿੱਖਣੀ ਹੋਵੇ ਤਾਂ ਉਹ ਵੀ ਅੱਜ ਕੱਲ੍ਹ ਬਜ਼ੁਰਗ ਇੰਟਰਨੈਟ ਦੇ ਜ਼ਮਾਨੇ ਦੇ ਰਾਹੀਂ ਟੈਕਨੋਲਜੀ ਤੋਂ ਉਹ ਔਨਲਾਈਨ ਸਿੱਖ ਸਕਦੇ ਹਨ ਇਹ ਬਿਰਧਾਂ ਦੇ ਨਾਲ ਨਾਲ ਇਹ ਦ੍ਰਿਸ਼ਟੀਹੀਣਾਂ ਨੂੰ ਵੀ ਬਹੁਤ ਇਹਨਾਂ ਨੂੰ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਇਸ ਤੋਂ ਸਿੱਖਿਆ ਮਿਲਦੀ ਹੈ ਇਸ ਤੋਂ ਇਲਾਵਾ ਇਹ ਉੱਥੇ ਉਹ ਗੁਰਬਾਣੀ ਕੀਰਤਨ ਆਦਿ ਵੀ ਇੱਥੋਂ ਹੀ ਸੁਣ ਲੈਂਦੇ ਹਨ ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਟੈਕਨੋਲਜੀ ਰਾਹੀਂ ਬਿਰਧਾਂ ਦੀਆਂ ਆਸਾਨ ਹੋ ਚੁੱਕੀਆਂ ਹਨ ਕੋਈ ਵੀ ਨਵੀਂ ਚੀਜ਼ ਸਿੱਖਣੀ ਹੋਵੇ ਸਿਲਾਈ ਕਢਾਈ ਕੋਈ ਨਵੀਂ ਜੋ ਆਪਣੇ ਸੁਨੇਹਾ ਭੇਜਣਾ ਹੋਵੇ ਇਹ ਸਾਰੀਆਂ ਟੈਕਨੋਲੋਜੀਆਂ ਰਾਹੀਂ ਬਿਰਧ ਜਿਹੜੇ ਆ ਓ ਕਰ ਸਕਦੇ ਹਨ ਅਤੇ ਜਿਹਦਾ ਬਹੁਤ ਫਾਇਦਾ ਉਠਾ ਸਕ